ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਮੇਰੀ ਗੱਲ ਮਨਪ੍ਰੀਤ ਨਾਲ ਹੋਈ ਹੈ ਹਾਂਜੀ ਮੈਨੂੰ ਨਾ ਤੁਹਾਡਾ ਨੰਬਰ ਮੇਰੀ ਫਰੈਡ ਨੇ ਦਿੱਤਾ ਸੀ ਅਤੇ ਮੈਂ ਮੁੰਬਈ ਤੋਂ ਬੋਲਦੀ ਹਾਂ ਹਾਂਤੇ ਮੇਰਾ ਪਲੈਨ ਸੀ ਪੰਜਾਬ ਵਿਜਿਟ ਕਰਨ ਦਾ ਅਤੇ ਤੁ ਤੁਸੀਂ ਮੈਨੂੰ ਕੁਝ ਦੱਸ ਸਕਦੇ ਹੋ ਕਿ ਮਤਲਬ ਮੈਂ ਕਿਸ ਮੌਸਮ ਜਾਂ ਕਿਸ ਟਾਈਮ ਵਿਚ ਉਸ ਉੱਥੇ ਆਵਾਂ ਉੱਧਰ ਦੇ ਕਲਾਈਮੇਟ ਬਾਰੇ ਕੁਛ ਦੱਸ ਸਕਦੇ ਹੋ ਤਾਂ ਕਿ ਫਿਰ ਮੈਂ ਉਸੀ ਹਿਸਾਬ ਨਾਲ ਆਪਣਾ ਪਲੈਨ ਬਣਾਵਾਂ ਹਾਜੀ ਹਾਂਜੀ

ਹਾਂਜੀ ਹਾਂਜੀ

ਅੱਛਾ ਜੀ ਅਤੇ ਹੋਰ ਕੁਛ ਐਸਾ ਕਿ ਮਤਲਬ ਕਲਾਈਮੇਟ ਦੇ ਅਕੋਡਿੰਗ ਫਿਰ ਅਗਰ ਰੱਖੀਏ ਵੀ ਤਾਂ ਟੂਰ ਤੁਸੀਂ ਦੱਸੋ ਮਤਲਬ ਐਕਚੁਅਲੀ ਕਿਹੜਾ ਮੰਨਥ ਕਾਫੀ ਬੈਟਰ ਰਹੇਗਾ

ਅੱਛਾ ਜੀ ਮੈਨੂੰ ਨਹੀਂ ਪਤਾ ਸੀ ਪੰਜਾਬ ਦਾ ਕਲਾਈਮੇਟ ਐਵੇਂ ਹੈ ਬਟ ਕਿਉਂਕਿ ਇੱਥੇ ਮੁੰਬਈ 'ਚ ਤੁਹਾਨੂੰ ਪਤਾ ਹੀ ਹੋਣਾ ਕਦੇ ਮੀਂਹ ਪੈਣ ਲੱਗ ਜਾਂਦਾ ਕਦੇ ਧੁੱਪ ਸੋ ਮੈਨੂੰ ਥੈਂਕ ਯੂ ਦੱਸਣ ਲਈ ਕਲਾਈਮੇਟ ਦੇ ਚੇਂਜਿੰਗ ਬਾਰੇ ਤਾਂ ਫਿਰ ਮੈਂ ਚਲੋ ਇਸੇ ਦੇ ਅਕੋਡਿੰਗ ਆਪਣਾ ਪਲਾਨ ਕਰਾਂਗੀ ਉੱਥੇ ਪਟਿਆਲਾ ਪੰਜਾਬ ਵਿਜਿਟ ਕਰਨ ਦਾ ਥੈਂਕ ਯੂ ਥੈਂਕ ਯੂ ਬਹੁਤ